ਸਤਿ ਸ੍ਰੀ ਅਕਾਲ ਵੀਰ ਜੀ ਹਾਂਜੀ ਵਧੀਆ ਜੀ ਤੁਸੀਂ ਦੱਸੋ ਜੀ ਹਾਂਜੀ ਸਭ ਵਧੀਆ ਜੀ ਤੁਸੀਂ ਦੱਸੋ ਤੋ ਮੈਂ ਨਾ ਬੱਚਿਆਂ ਨੂੰ ਪੜ੍ਹਨ ਪਾਉਣਾ ਸੀਗਾ ਆਪਣਿਆਂ ਨੂੰ ਹਾਂਜੀ ਤੇ ਤੁਹਾਡੀ ਨਿਗਹਾ 'ਚ ਕਿਹੜੇ ਸਕੂਲ ਵਧੀਆ ਨੇ ਹਾਂਜੀ ਅੱਛਾ ਜੀ ਅੱਛਾ ਜੀ ਹਾਂਜੀ ਅੱਛਾ ਜੀ ਤੇ ਕਿਵੇਂ ਐਕਟੀਵ ਵਧੀਆ ਹੁੰਦੀਆਂ ਸਾਰੇ ਸਕੂਲ 'ਚ ਹਾਂਜੀ ਬਾਈ ਜੀ ਹਾਂਜੀ ਤੇ ਆਪਾਂ ਨੂੰ ਪੈਸੇ ਦੀ ਕੋਈ ਦਿੱਕਤ ਨਹੀਂ ਹੈ ਬਸ ਬੱਚੇ ਪੜ੍ਨੇ ਚਾਹੀਦੇ ਆ ਆਪਣੇ ਅੱਛਾ ਜੀ ਹਾਂਜੀ ਹਾਂਜੀ ਚਲੋ ਵਧੀਆ ਗੱਲ ਹੈ ਹਾਂਜੀ ਹਾਂਜੀ

ਅੱਛਾ ਜੀ ਹਾਂਜੀ ਹਾਂਜੀ ਕਿਉਂਕਿ ਆਪਾਂ ਬੱਚਾ ਤੇ ਕੰਟਰੋਲ ਅੱਛਾ ਜੀ ਅੱਛਾ ਜੀ

ਹਾਂਜੀ ਹਾਂਜੀ ਹਾਂਜੀ ਹਾਂਜੀ ਇਹ ਤਾਂ ਗੱਲ ਹੈਗੀ ਬਈ ਹਾਂਜੀ ਅੱਛਾ ਜੀ

ਤੇ ਮੈਂ ਉਸੇ ਉਹੀ ਸੋਚਿਆ ਮੈਂ ਕਿਹਾ ਤੁਹਾਡੀ ਸਲਾਹ ਲੈਦੇ ਆ ਤੁਹਾਡੇ ਬੱਚੇ ਪੜ੍ਦੇ ਆ ਤੇ ਹੁਣ ਆਪਣੇ ਬੱਚੇ ਹਾਲੇ ਨਿੱਕੇ ਅਤੇ ਹੁਣ ਪੜਨ ਪਾਉਂਣਾ ਸੀਗਾ ਉਹਨਾਂ ਨੂੰ ਤੇ ਮੈਂ ਸੋਚਿਆ ਤੁਹਾਡੀ ਸਲਾਹ ਜਰੂਰ ਲਈ ਜਾਵੇ ਹਾਂਜੀ ਹਾਂਜੀ ਠੀਕ ਹੈ ਵੀਰ ਜੀ ਓਕੇ ਜੀ ਓਕੇ